ਮੇਰੇ ਕੋਲ ਮੇਰੀ ਮਨਪਸੰਦ ਕਿਤਾਬ ਗੋਦਾਨ ਹੈ ਜਿਹੜੀ ਮੁਨਸ਼ੀ ਪ੍ਰੇਮ ਚੰਦ ਨੇ ਲਿਖੀ ਹੈ ਇਹ ਕਿਤਾਬ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਇਸ ਕਿਤਾਬ ਵਿੱਚ ਜਿਹੜੀ ਹੈ ਇੱਕ ਗਰੀਬ ਵਰਗ ਦੀਆਂ ਮਜ਼ਬੂਰੀਆਂ ਹੁੰਦੀਆਂ ਹਨ ਅਤੇ ਇੱਕ ਕਿਸਾਨ ਦੀਆਂ ਜਿਹੜੀਆਂ ਮਜ਼ਬੂਰੀਆਂ ਹੁੰਦੀਆਂ ਹਨ ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ ਕਿਵੇਂ ਉਹ ਆਪਣਾ ਗੁਜ਼ਾਰਾ ਕਰਦੇ ਆ ਅਤੇ ਕਿਵੇਂ ਉਹ ਸ਼ਾਹੂਕਾਰਾਂ ਦੇ ਚੰਗੁਲ 'ਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਨ ਅਤੇ ਉਹਨਾਂ ਦੇ ਦੇਣਦਾਰ ਬਣੇ ਰਹਿੰਦੇ ਹਨ ਇਹ ਕਿਤਾਬ ਮੇਰੇ ਦਿਲ ਨੂੰ ਛੂਹ ਲੈਂਦੀ ਹੈ ਅਤੇ ਜੋ ਇੱਕ ਪਿਛਲੇ ਸਮੇਂ 'ਚ ਵੀ ਲੋਕਾਂ ਦੇ ਸ਼ਾਹੂਕਾਰਾਂ ਨੇ ਬੁਰੇ ਹਾਲਾਤ ਕੀਤੇ ਹੋਏ ਸੀ ਅਤੇ ਉਹ ਹਾਲਾਤ ਅੱਜ ਜਿਹੜੇ ਗਰੀਬ ਲੋਕ ਹਨ ਅਤੇ ਉਹ ਬੇਚਾਰੇ ਜਗ੍ਹਾ ਜਗ੍ਹਾ ਤੋਂ ਲੋਨ ਲੈ ਕੇ ਅਤੇ ਹਾਈ ਵਾ ਰੇਟ ਜਿਹਦੇ 'ਤੇ ਵਿਆਜ ਦੇ ਦਰਾਂ ਨੂੰ ਭਰ ਭਰ ਰਹੇ ਹਨ ਕਾਫੀ ਜ਼ਿਆਦਾ ਸਮਾਨਤਾ ਹੈਗੀ ਹੈ ਇਸ ਗੋਦਾਨ 'ਚ ਇਸ ਕਿਤਾਬ ਦੇ ਵਿੱਚ ਜੋ ਪੇਸ਼ ਕੀਤੀ ਗਈ ਹੈ ਸਥਿਤੀ ਕਿਸਾਨਾਂ ਦੀ ਅਤੇ ਪਿਛੜੇ ਵਰਗ ਦੀ ਉਹ ਅੱਜ ਵੀ ਕਈ ਪਿਛੜੇ ਇਲਾਕਿਆਂ ਦੀ ਸਥਿਤੀ ਸੇਮ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਕਿਤਾਬ ਦੇ ਉੱਪਰ ਕੋਈ ਫਿਲਮ ਬਣੇ ਕਿਉਂਕਿ ਕਿਤਾਬਾਂ ਲੋਕ ਇੰਨੀਆਂ ਪੜ੍ਹਨੀਆਂ ਪਸੰਦ ਨਹੀਂ ਕਰਦੇ ਜਿੰਨਾ ਕਿ ਉਹ ਫਿਲਮਾਂ ਇੱਕ ਵੀਡੀਓ ਨੂੰ ਵੇਖਣਾ ਪਸੰਦ ਕਰਦੇ ਹਨ ਅਤੇ ਅੱਜ ਕੱਲ੍ਹ ਦੇ ਬੱਚੇ ਵੀਡੀਓ ਵੇਖ ਕੇ ਬਹੁਤ ਕੁਝ ਸਿੱਖਦੇ ਹਨ ਮੈਂ ਚਾਹੁੰਦੀ ਹਾਂ ਕਿ ਇਸ ਕਿਤਾਬ ਦੇ ਉੱਪਰ ਫਿਲਮ ਬਣੇ ਅਤੇ ਉਹਨੂੰ ਅੱਜ ਦੀ ਜਿਹੜੀ ਯੁਵਾ ਪੀੜ੍ਹੀ ਹੈ ਯੁਵਾ ਵਰਗ ਹੈ ਅਤੇ ਉਸ ਫਿਲਮ ਨੂੰ ਵੇਖੇ ਅਤੇ ਉਹ ਇੱਕ ਜੋ ਬੁਰੇ ਹਾਲਾਤ ਦਿਨ ਬ ਦਿਨ ਸਾਡੇ ਦੇਸ਼ 'ਚ ਰਾਜ 'ਚ ਵੀ ਵਿਗੜ ਰਹੇ ਹਨ ਕਿਸਾਨਾਂ ਦੇ ਅਤੇ ਗਰੀਬ ਲੋਕਾਂ ਦੇ ਅਤੇ ਉਹਨਾਂ ਦੀਆਂ ਮਜ਼ਬੂਰੀਆਂ ਅਤੇ ਉਹਨਾਂ ਦੇ ਹਾਲਾਤਾਂ ਨੂੰ ਉਹ ਸਮਝ ਸਕਣ